ਪੰਜਾਬ ਦਾ ਭੂਗੋਲ ਜਿਵੇਂ ਕਿ ਪੰਜਾਬ ਵੰਡ ਤੋਂ ਪਹਿਲਾਂ ਬਹੁਤ ਵੱਡਾ ਸੀ ਅਤੇ ਇਸਦੇ ਸੋਲ੍ਹਾਂ ਜ਼ਿਲ੍ਹੇ ਸਨ ਅਤੇ ਬਾਅਦ ਵਿੱਚ ਵੰਡ ਹੋ ਗਈ ਅਤੇ ਅੱਧਾ ਪੰਜਾਬ ਪਾਕਿਸਤਾਨ ਵਿੱਚ ਰਹਿ ਗਿਆ ਅਤੇ ਅੱਧਾ ਪੰਜਾਬ ਹਿੰਦੁਸਤਾਨ ਵਿੱਚ ਆ ਗਿਆ ਅਤੇ ਹੁਣ ਇਸ ਦੇ ਬਾਈ ਜ਼ਿਲ੍ਹੇ ਹਨ ਅਤੇ ਇਸਦੇ ਵਾਤਾਵਰਨ ਜਿਵੇਂ ਕਿ ਇਸ ਇੱਥੇ ਗਰਮੀ ਸਰਦੀ ਬਰਸਾਤ ਸਭ ਕੁਝ ਮਤਲਬ ਤਿੰਨੋ ਚਾਰੋ ਵਾਤਾਵਰਨ ਵਿੱਚ ਮੌਸਮ ਬਦਲਦੇ ਹਨ ਅਤੇ ਇਸਦਾ ਇਤਿਹਾਸ ਪੁਰਾਣਾ ਗੁਰੂਆਂ ਤੋਂ ਲਓ ਸ਼ੁਰੂ ਹੋ ਕੇ ਬਾਅਦ ਵਿੱਚ ਰਾਜਿਆਂ ਨੇ ਇੱਥੇ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਅਤੇ ਲੋਕਾਂ ਨੂੰ ਬਹੁਤ ਖੁਸ਼ ਰੱਖਿਆ ਅਤੇ ਇੱਥੇ ਉਹਨਾਂ ਨੇ ਪੂਰੇ ਆਪਣੇ ਆਪਣੀ ਰਾਜ ਵਿੱਚ ਲੋਕਾਂ ਨੂੰ ਸਭ ਕੁਝ ਕਿਸੇ ਨੂੰ ਨਿਰਾਸ਼ਾ ਨਹੀਂ ਦਿੱਤੀ ਅਤੇ ਅੱਜ ਦੇ ਪੰਜਾਬ ਵਿੱਚ ਹੁਣ ਤੱਕ ਕਾਫੀ ਵਿਕਾਸ ਹੋਇਆ ਹੈ ਜਿਵੇਂ ਕਿ ਨਦੀਆਂ ਬਣਾਈਆਂ ਗਈਆਂ ਨਵੀਆਂ ਦਰਿਆਵਾਂ ਵਿੱਚੋਂ ਕੱਢ ਕੇ ਸੜਕਾਂ ਨਵੀਆਂ ਬਣਾਈਆਂ ਗਈਆਂ ਅਤੇ ਗੁਰਦੁਆਰੇ ਪਹਿਲਾਂ ਛੋਟੇ ਸੀ ਹੁਣ ਵੱਡੇ ਅਕਾਰ ਦੇ ਗੁਰਦੁਆਰੇ ਅਤੇ ਹੋਰ ਜਿਵੇਂ ਕਿ ਬਿਲਡਿੰਗਾਂ ਦਫਤਰ ਸਾਰੇ ਬਹੁਤ ਵਧੀਆ ਹੁਣ ਵਿਕਾਸ ਹੋਇਆ ਹੈ ਪੰਜਾਬ ਵਿੱਚ